ਸਾਡੇ ਖੇਤਰ ਵਿੱਚ ਕਈ ਪ੍ਰਕਾਰ ਦੇ ਜਨਤਕ ਬੈਂਕ ਹਨ ਜਿਵੇਂ ਕਿ ਕੋਆਪਰੇਟਿਵ ਬੈਂਕ ਐਸ ਬੀ ਆਈ ਬੈਂਕ ਪੰਜਾਬ ਨੈਸ਼ਨਲ ਬੈਂਕ ਪੰਜਾਬ ਐਂਡ ਸਿੰਧ ਬੈਂਕ ਡਾਕਖਾਨੇ ਆਦਿ ਬਹੁਤ ਸਾਰੇ ਜਨਤਕ ਬੈਂਕ ਹਨ ਬੀਮਾ ਬੀਮਿਆਂ ਵਿੱਚ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਬੀਮਾ ਕਰਵਾਉਣ ਨਾਲ ਸਾਡੀ ਇੱਕ ਬੱਚਤ ਹੁੰਦੀ ਹੈ ਜੀਵਨ ਦਾ ਰਿਸਕ ਕਵਰ ਹੁੰਦਾ ਹੈ ਇਸ ਲਈ ਬੀਮੇ ਦਾ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਬੀਮਾ ਕਰਵਾਉਣ ਨਾਲ ਸਾਡਾ ਫਿਊਚਰ ਵਿੱਚ ਸਾਨੂੰ ਕਿਸੇ ਵੀ ਪ੍ਰਕਾਰ ਦੀ ਘਟਨਾ ਜਾਂ ਦੁਰਘਟਨਾ ਹੋ ਜਾਂਦੀ ਹੈ ਤਾਂ ਉਸਦਾ ਕਵਰਿੰਗ ਹੋ ਜਾਂਦੀ ਹੈ ਜਿਸ ਦਾ ਪਰਿਵਾਰ ਨੂੰ ਫਾਇਦਾ ਹੁੰਦਾ ਹੈ ਇਸ ਲਈ ਜੀ ਜੀਵਨ ਬੀਮਾ ਵੀ ਬਹੁਤ ਵਧੀਆ ਉਪਕਰਨ ਹੈ ਬੈਂਕ ਅਤੇ ਜੀਵਨ ਬੀਮਿਆਂ ਵਿੱਚ ਦੋਵੇਂ ਹੀ ਬਿਹਤਰ ਤਰੀਕ ਸੁਰੱਖਿਅਤ ਹਨ ਅਤੇ ਬਿਹਤਰ ਹਨ ਇਸ ਲਈ ਸਾਨੂੰ ਜਿਸ ਵਿੱਚ ਚੰਗਾ ਲੱਗੇ ਉਸ ਵਿੱਚ ਆਪਣਾ ਖਾਤਾ ਕਰਵਾ ਲੈਣਾ ਚਾਹੀਦਾ ਹੈ